ਕੀ ਤੁਹਾਨੂੰ ਬ੍ਰਹਮੰਡ ਹਮੇਸ਼ਾ ਮੰਨੋਰੰਜਨ ਦਾ ਕਾਰਨ ਲੱਗਦਾ ਹੈ ਹਾਂ ਇਹ ਮੇਰੀ ਜਗਿਆਸਾ ਦਾ ਕਾਰਨ ਵੀ ਹੈ ਬ੍ਰਹਿਮੰਡ ਵਿੱਚ ਬਹੁਤ ਸਾਰੇ ਵਰਤਾਰੇ ਵਾਪਰਦੇ ਹਨ ਜਿਨ੍ਹਾਂ ਵਿੱਚੋਂ ਵਾਮਹੋਲ ਬਲੈਕ ਹੋਲ ਮੈਨੂੰ ਬਹੁਤ ਜ਼ਿਆਦਾ ਹੈਰਾਨੀ ਵਿੱਚ ਪਾ ਦਿੰਦੇ ਹਾਂ ਵਾਮਹੋਲ ਜਿਸਦੇ ਵਿੱਚੋਂ ਟਾਈਮ ਟਰੈਵਲ ਕੀਤਾ ਜਾ ਸਕਦਾ ਹੈ ਅਤੇ ਬਲੈਕ ਹੋਲ ਜੋ ਕਿ ਪੂਰੇ ਬ੍ਰਹਮੰਡ ਨੂੰ ਖਾ ਜਾਣ ਦੀ ਸਮਰਥਾ ਰੱਖਦਾ ਹੈ ਕਿੰਨੀ ਜ਼ਿਆਦਾ ਇੰਟਰਸਟਿੰਗ ਗੱਲ ਹੈ ਇੰਨੀ ਦਿਲਚਸਪੀ ਦੇ ਨਾਲ ਮੈਂ ਕੋਈ ਵਿਸ਼ਾ ਵੀ ਨਹੀਂ ਪੜ੍ਹਦੀ ਜਿੰਨੀ ਰੌਚਕ ਤਰੀਕੇ ਨਾਲ ਮੈਨੂੰ ਬ੍ਰਹਮੰਡ ਬਾਰੇ ਜਾਣਨਾ ਪਸੰਦ ਹੈ ਤੁਸੀਂ ਜਾਣਦੇ ਹੀ ਹੋਵੋਗੇ ਕਿ ਸਾਡੇ ਬ੍ਰਾਹਮੰਡ ਵਿੱਚ ਦਸ ਦੀ ਸ਼ਕਤੀ ਗਿਆਰ੍ਹਾਂ ਦੇ ਲਗਭਗ ਗਲੈਕਸੀਆਂ ਹਨ ਇਕ ਗਲੈਕਸੀ ਵਿੱਚ ਕਰੋੜਾਂ ਤਾਰੇ ਹਨ ਸਾਡੀ ਆਪਣੀ ਗਲੈਕਸੀ ਦਾ ਨਾਮ ਆਕਾਸ਼ ਗੰਗਾ ਹੈ ਤੁਸੀਂ ਇਸ ਨੂੰ ਕਿਸੇ ਸਾਫ਼ ਸੁਥਰੇ ਦਿਨ ਵੇਖ ਵੀ ਸਕਦੇ ਹੋ ਆਕਾਸ਼ ਦੇ ਵਿੱਚ ਇਹ ਦੁਧੀਆ ਰੰਗ ਦੀ ਨਜ਼ਰ ਆਉਂਦੀ ਹੈ ਜਿਸ ਨੂੰ ਦੇਖ ਕੇ ਬੜੀ ਹੈਰਾਨੀ ਹੁੰਦੀ ਹੈ ਕਿ ਅਸੀਂ ਕਿੰਨੇ ਵੱਡੇ ਬ੍ਰਹਮੰਡ ਵਿੱਚ ਰਹਿੰਦੇ ਹਾਂ ਮੈਨੂੰ ਇਹ ਸਾਰੀਆਂ ਜਾਣਕਾਰੀਆਂ ਬਹੁਤ ਉਤਸਾਹਿਤ ਕਰਦੀਆਂ ਹਨ ਤੇ ਵਿਗਿਆਨ ਦੇ ਵਿੱਚ ਮੇਰਾ ਮੇਰੀ ਦਿਲਚਸਪੀ ਜਗਾਉਂਦੀਆਂ ਹਨ